ਹੈਲੋ ਸ ਸਰ ਮੈਂ ਤੁਹਾਨੂੰ ਕਹਿਣਾ ਸੀ ਕਿ ਮੈਂ ਤੁਹਾਡੇ ਨਾ ਹੁਣੇ ਹੁਣੇ ਗੁਆਂਡ ਵਿੱਚ ਸ਼ਿਫਟ ਹੋਇਆ ਹਾਂ ਅਤੇ ਮੈਨੂੰ ਨਾ ਤੁਹਾਡੀ ਥੋੜ੍ਹੀ ਮਦਦ ਚਾਹੀਦੀ ਸੀ ਹਾਂਜੀ ਹਾਂਜੀ ਉਹ ਮੈਨੂੰ ਤੁਹਾਡੀ ਨਾ ਉਹ ਮਦਦ ਚਾਹੀਦੀ ਕਿ ਮੈਨੂੰ ਨਾ ਇੱਥੇ ਨਾ ਟ੍ਰਾਂਸਫੋਰ ਸਿਸਟਮ ਬਾਰੇ ਪਤਾ ਨਹੀਂ ਗਾ ਅਤੇ ਮੈਂ ਨਾ ਬਜ਼ਾਰ ਜਾਣਾ ਸੀ ਅਤੇ ਇਸ ਲਈ ਮੈਨੂੰ ਨਾ ਤੁਹਾਡੀ ਚਾਹੀਦੀ ਪਤਾ ਚਾਹੀਦਾ ਕਿ ਟ੍ਰਾਂਸਫੋਰ ਸਿਸਟਮ ਇੱਥੋ ਦਾ ਕਿਹੋ ਜਿਹਾ ਹੈ ਅਤੇ ਨਾ ਫਿਰ ਮੈਨੂੰ ਨਾ ਤੁਹਾਡੀ ਹੁਣ ਮਦਦ ਚਾਹੀਦੀ ਥੋੜ੍ਹੀ ਕੀ ਕਹਿੰਦੇ ਆ ਮੈਨੂੰ ਨਾ ਤੁਹਾਡੇ ਨਾਲ ਬਜ਼ਾਰ ਜਾਣਾ ਤੁਸੀਂ ਮੇਰੇ ਨਾਲ ਨਾਲ ਚੱਲ ਜਾਓ ਅਤੇ ਮੈਨੂੰ ਤੁਹਾਡਾ ਫਿਰ ਵਹੀਕਲ ਚਾਹੀਦਾ ਹੈ ਹਾਂਜੀ ਹਾਂਜੀ ਫਿਰ ਤਾਂ ਠੀਕ ਠੀਕ ਫਿਰ ਤੁਸੀਂ ਮੇਰੇ ਨਾਲ ਹੀ ਚੱਲ ਪਿਓ ਵਾਹੀਕਲ 'ਤੇ ਹਾਂਜੀ ਹਾਂਜੀ ਠੀਕ ਠੀਕ ਮੈਂ ਤੁਹਾਨੂੰ ਦੁਬਾਰਾ ਫੋਨ ਕਰਦਾ